ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਪਾਲਜੀਤ ਸਿੰਘ ਆ ਅਤੇ ਜਿਵੇਂ ਕਿ ਸਾਨੂੰ ਪਤਾ ਹੈ ਕਿ ਸਾਡੇ ਦੇਸ਼ ਵਿੱਚ ਸਾਡੇ ਆਲੇ ਦੁਆਲੇ ਵਿੱਚ ਡੇਂਗੂ ਬੁਖਾਰ ਮਲੇਰੀਆ ਵਰਗੀਆਂ ਮੱਛਰਾਂ ਤੋਂ ਹੋਣ ਵਾਲੀਆਂ ਕਈ ਬਿਮਾਰੀਆਂ ਫੈਲ ਰਹੀਆਂ ਹਨ ਜਿਨ੍ਹਾਂ ਤੋਂ ਬ ਛੋਟੇ ਬੱਚਿਆਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਉਹਨਾਂ ਬਿਮਾਰੀਆਂ ਵੱਧ ਰਹੀਆਂ ਹਨ ਉਹਨਾਂ ਨੂੰ ਬੁਖਾਰ ਹੋਇਆ ਰਹਿੰਦਾ ਹੈ ਜਿਨ੍ਹਾਂ ਕਰਕੇ ਜਿਸ ਕਰਕੇ ਉਹਨਾਂ ਦਾ ਸਕੂਲ ਮਿਸ ਹੋਇਆ ਰਹਿੰਦਾ ਹੈ ਅਤੇ ਜੋ ਕਿ ਚੰਗਾ ਨਹੀਂ ਹੈ ਜਿਸ ਕਰਕੇ ਉਹ ਚੰਗੇ ਨਹੀਂ ਹਨ ਅਤੇ ਸਾਨੂੰ ਇਹਨਾਂ ਬਿਮਾਰੀਆਂ ਤੋਂ ਬਚਣ ਲਈ ਕਈ ਕੁਛ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਹੜਾ ਕਿ ਹਰ ਇੱਕ ਨੂੰ ਪਾਲਣਾ ਕਰਨੀ ਚਾਹੀਦੀ ਹੈ ਡੇਂਗੂ ਮਲੇਰੀਆ ਦੇ ਮੱਛਰਾਂ ਤੋਂ ਬਚਣ ਲਈ ਸਾਨੂੰ ਜਾਲੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਾਲੀ ਰੱਖਣੀ ਚਾਹੀਦੀ ਜਾਂ ਆਲ ਆਊਟ ਵਰਗੀਆਂ ਚੀਜ਼ਾਂ ਹਮੇਸ਼ਾ ਆਪਣੇ ਲਾਗੇ ਰੱਖਣੀਆਂ ਚਾਹੀਦੀਆਂ ਹਨ ਇਸ ਕਰਕੇ ਸਾਨੂੰ ਜ਼ਿਆਦਾ ਖਤਰਾ ਨਾ ਹੋਵੇ ਖਤਰਾ ਨਾ ਹੋਵੇ ਕਿ ਸਾਰੇ ਬੱਚੇ ਸਹੀ ਰਹਿਣ ਉਹਨਾਂ ਤੋਂ ਉਹਨਾਂ ਤੋਂ ਉਹਨਾਂ ਦੇ ਬੱਚਿਆਂ ਤੋਂ ਜਾਂ ਪੇਰੈਂਟਸ ਨੂੰ ਨਾ ਹੋਵੇ ਇਸ ਕਰਕੇ ਕੋਈ ਹੋਰ ਬਿਮਾਰੀ ਨਾ ਵਧੇ ਅਤੇ ਇਹ ਬਹੁਤ ਲਾਜ਼ਮੀ ਹੈ ਜੇਕਰ ਕਿ ਇਹ ਹੋਵੇਗਾ ਤਾਂ ਮੱਛਰ ਨਾਲ ਡੇਂਗੂ ਮਲੇਰੀਆ ਵਰਗੀਆਂ ਬਿਮਾਰੀਆਂ ਵੱਧ ਨਹੀਂ ਫੈਲਣਗੀਆਂ ਇੱਥੇ ਅਸੀਂ ਸਾਰੇ ਅਸੀਂ ਸਾਡਾ ਸਮਾਜ ਬਹੁਤ ਸੁਰੱਖਿਅਤ ਸਾਡਾ ਆਲਾ ਦੁਆਲਾ ਇੱਕਦਮ ਸੁਰੱਖਿਅਤ ਰਹੇਗਾ ਜਿਸ ਨਾਲ ਸਾਰੇ ਖੁਸ਼ ਰਹਿਣਗੇ ਅਤੇ ਕਿਸੇ ਨੂੰ ਕੋਈ ਬਿਮਾਰੀ ਨਹੀਂ ਆਏਗੀ ਅਤੇ ਸਾਨੂੰ ਇਹ ਕੁਛ ਨਿਯਮਾਂ ਦਾ ਪਾਲਣਾ ਕਰਨਾ ਚਾਹੀਦਾ ਹੈ ਇਸ ਬਿਮਾਰੀਆਂ ਤੋਂ ਬਚਣ ਲਈ ਧੰਨਵਾਦ